ਹਾਂਜੀ ਅਸੀਂ ਧਾਰਮਿਕ ਪੁਸਤਕਾਂ ਵਿੱਚੋਂ ਹਾਈਤਾਂ ਅਤੇ ਸਲੋਕ ਵੀ ਪੜ੍ਹਦੇ ਹਾਂ ਕਿ ਸਾਡਾ ਮੇਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਅਸੀਂ ਉਹਨਾਂ ਨੂੰ ਮੰਨਦੇ ਹਨ ਅਤੇ ਉਹਨਾਂ ਦੇ ਸਲੋਕ ਪੜ੍ਹਦੇ ਹਾਂ ਕਿ ਸਾਨੂੰ ਕਈ ਸਲੋਕ ਕਿਉਂਕਿ ਗੁਰਬਾਣੀ ਦਾ ਅਰਥ ਬਹੁਤ ਡੂੰਘਾ ਹੁੰਦਾ ਹੈ ਇਸਦੇ ਹਰ ਸਲੋਕ ਦਾ ਅਰਥ ਅਲੱਗ ਅਲੱਗ ਹੈ ਸਾਰੇ ਸਲੋਕ ਹੀ ਪ੍ਰਭਾਵਸ਼ਾਲੀ ਹਨ ਅਤੇ ਸਾਰਿਆਂ ਹੀ ਵਿੱਚ ਯੋਗਦਾਨ ਬਣਦਾ ਹੈ ਪਹਿਲਾਂ ਤਾਂ ਮੁੱਖ ਉਦਾਹਰਨ ਹੈ ਕਿ ਬਾਣੀ ਗੁਰੂ ਹੈ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਾ ਨਿਸਤਾਰੇ ਕਿਉਂਕਿ ਜਿਹੜੀ ਗੁਰਬਾਣੀ ਹੈ ਗੁਰਬਾਣੀ ਹੀ ਅੰਮ੍ਰਿਤ ਹੈ ਅਤੇ ਇਸ ਦੇ ਵਿੱਚ ਹੀ ਅੰਮ੍ਰਿਤ ਹੈ ਕਿਉਂਕਿ ਕਈ ਲੋਕ ਕਹਿੰਦੇ ਨਸ਼ਾ ਕਰਦੇ ਨੇ ਦਾਰੂ ਮੀਟ ਇਹਨਾਂ ਚੀ ਦਾਰੂ ਸ਼ਰਾਬ ਦਾ ਕਿਉਂਕਿ ਨਸ਼ਾ ਕਰਨਾ ਹੈ ਗੁਰਬਾਣੀ ਦਾ ਕਰੋ ਜਿਹੜਾ ਤੁਹਾਨੂੰ ਸਹੀ ਸੇਧ ਪ੍ਰਦਾਨ ਕਰੇਗਾ ਰੱਬ ਨਾਲ ਜੋੜੇਗਾ ਕਿ ਮਹਾਰਾਜ ਨੇ ਇਹ ਵੀ ਦਰਸਾਇਆ ਹੈ ਕਿ ਕਹਿੰਦੇ ਭਈ ਪਰਾਪਤਿ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਕਹਿੰਦੇ ਤੈਨੂੰ ਮਨੁੱਖ ਦੇਹ ਮਿਲੀ ਹੈ ਤੈਨੂੰ ਮਨੁੱਖੀ ਸਰੀਰ ਮਿਲਿਆ ਹੈ ਤੂੰ ਇਸਨੂੰ ਗਲਤ ਪਾਸੇ ਨਾ ਲਾ ਨਸ਼ਿਆਂ ਵਾਲੇ ਪਾਸੇ ਨਾ ਲਾ ਜਾਂ ਕਿਸੇ ਹੋਰ ਗਲਤ ਪਾਸੇ ਨਾ ਲਾ ਇਸਨੂੰ ਰੱਬ ਵੱਲ ਜੋੜ ਅਤੇ ਆਪਣੀ ਭਗਤੀ ਕਰ ਅਤੇ ਆਪਣਾ ਰਾਹ ਸਿੱਧਾ ਕਰ ਕਿਉਂਕਿ ਅੱਗੇ ਕਰਮਾਂ ਦਾ ਲੇਖਾ ਹੁੰਦਾ ਹੈ ਅਤੇ ਨਾ ਕਿ ਕਿਸੇ ਆਹ ਦਾ ਕਿ ਤੂੰ ਕਿਹੜੀ ਜਾਤ ਦਾ ਹੈ ਕਿੰਨੇ ਪੈਸੇ ਨੇ ਤੇਰੇ ਕੋਲ ਕਿੰਨਾਂ ਅਮੀਰ ਆ ਕਿੰਨਾਂ ਗਰੀਬ ਹੈ ਨਹੀਂ ਇਹ ਗੱਲ ਦਾ ਵਿਤਕਰਾ ਨਹੀਂ ਹੁੰਦਾ ਇੱਥੇ ਸਾਰੇ ਧਰਮਾਂ ਨੂੰ ਇੱਕ ਜੋੜ ਕੇ ਇੱਕੋ ਬਰਾਬਰ ਉਹਨਾਂ ਨੂੰ ਸੇਧ ਪ੍ਰਦਾਨ ਕੀਤੀ ਕਿਉਂਕਿ ਸਾਰੇ ਧਰਮ ਇੱਕੋ ਹੀ ਹਨ ਅਤੇ ਇੱਕ ਰੱਬ ਨਾਲ ਜੋੜਦੇ ਹਨ